ਭਾਰਤ ਵਿੱਚ ਕਾਫੀ ਸਿਆਸੀ ਪਾਰਟੀਆਂ ਹਨ ਜਿਵੇਂ ਬੀ ਜੇ ਪੀ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਇਹ ਪਾਰਟੀਆਂ ਆਪਣੇ ਆਪਣੇ ਸਮੇਂ 'ਚ ਬਹੁਤ ਹੀ ਵਧੀਆ ਕੰਮ ਕਰਦੀਆਂ ਰਹੀਆਂ ਹਨ ਭਾਰਤ ਦੇ ਲੋਕਤੰਤਰ ਦੀ ਗੱਲ ਕੀਤੀ ਜਾਵੇ ਇਸ ਬਾਰੇ ਇੱਕ ਚੀਜ਼ ਜੋ ਕਿ ਮੈਨੂੰ ਬਹੁਤ ਹੀ ਪਸੰਦ ਹੈ ਇੱਥੇ ਹਰ ਪੰਜ ਸਾਲ ਬਾਅਦ ਸਾਨੂੰ ਆਪਣਾ ਨੇਤਾ ਚੁਣਨ ਦਾ ਹੱਕ ਹੈ ਅਤੇ ਜੋ ਚੀਜ਼ ਮੈਨੂੰ ਇਸ ਵਿੱਚ ਨਾ ਪਸੰਦ ਹੈ ਕਿ ਇਹ ਸਮਾਂ ਪੰਜ ਸਾਲ ਦਾ ਘਟਾ ਕੇ ਤਿੰਨ ਸਾਲ ਦਾ ਕਰ ਦੇਣਾ ਚਾਹੀਦਾ ਹੈ ਇੱਥੇ ਬਹੁਤ ਵਧੀਆ ਰਾਜਨੀਤਿਕ ਨੇਤਾ ਹਨ ਕਿਸੇ ਇੱਕ ਦੀ ਗੱਲ ਨਹੀਂ ਕਰ ਸਕਦੇ ਸਭ ਨੇ ਵਧੀਆ ਤੋਂ ਵਧੀਆ ਕੰਮ ਕੀਤਾ ਹੈ ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਉਹਨਾਂ ਨੂੰ ਐਜੂਕੇਸ਼ਨ ਸਿਸਟਮ ਬਾਰੇ ਜ਼ਰੂਰ ਪੁੱਛਾਂਗੀ ਕਿ ਤੁਸੀਂ ਇਸ ਨੂੰ ਹੋਰ ਬਿਹਤਰ ਕਿਵੇਂ ਕਰੀਏ ਅਤੇ ਤੁਹਾਡੀ ਸਰਕਾਰ ਇਸਨੂੰ ਅੱਗੇ ਲਿਆਉਣ 'ਚ ਕੀ ਸਕੀਮ ਅਪਣਾਏਗੀ